ਭਾਰਤ ਵਿੱਚ ਪੰਜਾਬੀ ਸਿੰਗਰਾਂ ਦੇ ਜਿਹੜੇ ਹੈਗੇ ਗਾਣੇ ਬਹੁਤ ਜ਼ਿਆਦਾ ਮਤਲਬ ਉਹਨਾਂ ਦਾ ਪ੍ਰਭਾਵ ਹੈਗਾ ਜਿਵੇਂ ਪੁਰਾਣੇ ਸਿੰਗਰ ਹੈਗੇ ਆ ਗੁਰਦਾਸ ਮਾਨ ਉਹਨਾਂ ਦੇ ਗਾਣੇ ਜਿਹੜੇ ਹੈਗੇ ਬਹੁਤ ਜ਼ਿਆਦਾ ਸੁਣੇ ਜਾਂਦੇ ਹਨ ਅਤੇ ਉਸ ਤੋਂ ਪਹਿਲਾਂ ਕੁਲਦੀਪ ਮਾਣਕ ਸਰ ਸਾਹਿਬ ਸੀ ਉਹਨਾਂ ਦੇ ਵੀ ਗਾਣੇ ਬਹੁਤ ਜ਼ਿਆਦਾ ਸੁਣੇ ਜਾਂਦੇ ਅਤੇ ਹੁਣ ਅੱਜ ਕੱਲ੍ਹ ਦੇ ਟਾਈਮ ਵਿੱਚ ਹੈਗੇ ਕੁਛ ਸਿੰਗਰ ਜਿਹੜੇ ਹੁਣ ਨਵੇਂ ਆਏ ਹਨ ਜਿਵੇਂ ਜੈਜੀ ਬੀ ਹੋ ਗਿਆ ਦਿਲਜੀਤ ਜਾਂ ਹੋਰ ਜਿਹੜੇ ਸਿੰਗਰ ਹੈਗੇ ਆ ਉਹਨਾਂ ਦੇ ਗਾਣੇ ਕਾਫ਼ੀ ਜ਼ਿਆਦਾ ਮਸ਼ਹੂਰ ਹਨ ਜਿਹੜੇ ਕਿ ਸਾਰੇ ਸੁਣਦੇ ਹਨ ਇਹਨਾਂ ਗਾਣਿਆਂ ਇਹਨਾਂ ਦੇ ਗਾਣੇ ਪਰਿਵਾਰਕ ਵੀ ਹੁੰਦੇ ਹਨ ਜਿਨ੍ਹਾਂ ਗਾਣਿਆਂ ਦੇ ਕਰਕੇ ਇਹਨਾਂ ਦੇ ਮਤਲਬ ਇਹ ਜ਼ਿਆਦਾ ਫੇਮਸ ਹੋ ਜਾਂਦੀ ਹਾਲੀਵੁੱਡ ਬੋਲੀਵੁੱਡ ਤੱਕ ਵੀ ਜਿਹੜੇ ਜਾਂ ਹਿੰਦੀ ਫਿਲਮਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਪੰਜਾਬੀ ਗਾਣੇ ਮਤਲਬ ਕਿ ਬਹੁਤ ਜ਼ਿਆਦਾ ਆਉਂਦੇ ਹਨ ਅਤੇ ਪੰਜਾਬੀ ਗਾਣੇ ਹੀ ਜ਼ਿਆਦਾ ਹਾਂ ਮਤਲਬ ਮਸ਼ਹੂਰ ਹਨ

ਐਂਡ ਵਿੱਚ ਲਾਸਟ ਵਿੱਚ ਪੰਜਾਬੀ ਗਾਣਾ ਹੀ ਬੋਲਿਆ ਜਾਂਦਾ ਹੈ ਪੰਜਾਬੀ ਗਾਣੇ ਗਾਣਿਆਂ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ ਭਾਰਤ ਵਿੱਚ ਪੰਜਾਬੀ ਗਾਣਿਆਂ ਦਾ ਜਿਹੜਾ ਹੈਗਾ ਪ੍ਰਭਾਵ ਹੈਗਾ ਉਹ ਦਿਨੋ ਦਿਨ ਵੱਧ ਰਿਹਾ ਹੈਗਾ ਅਤੇ ਪੰਜਾਬੀ ਜਿਹੜਾ ਹੈਗਾ ਸੱਭਿਆਚਾਰ ਹੈਗਾ ਉਹਦਾ ਉਹਦਾ ਬਹੁਤ ਜ਼ਿਆਦਾ ਅਸਰ ਹੋਇਆ ਹੈ ਪੰਜਾਬੀ ਗਾਣਿਆ ਦੇ ਪ੍ਰਭਾਵ ਕਰਕੇ ਹੀ ਪੰਜਾਬੀ ਗਾਣੇ ਅਤੇ ਪੰਜਾਬੀ ਸਿੰਗਰ ਭਾਰਤ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੇ ਹਨ ਅਤੇ ਉਹਨਾਂ ਨੂੰ ਅੱਜ ਕੱਲ੍ਹ ਦੇ ਟੈ ਸਮੇਂ ਵਿੱਚ ਸਾਰੇ ਸਾਰੇ ਜਾਣਦੇ ਹਨ ਕਿ ਇਹ ਪੰਜਾਬ ਨਾਲ ਸੰਬੰਧਿਤ ਹਨ ਅਤੇ ਪੰਜਾਬ ਦੇ ਗਾਣੇ ਅਤੇ ਪੰਜਾਬ ਦੇ ਸਿੰਗਰ ਹਨ ਜੋ ਕਿ ਦੁਨੀਆ ਦੇ ਹਰ ਕੋਨੇ ਵਿੱਚ ਉਹਨਾਂ ਨੂੰ ਸਾਰੇ ਸੁਣਦੇ ਹਨ ਅਤੇ ਬੋਲ ਸੁਣਦੇ ਹਨ ਅਤੇ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ